ਹੈਲੋ ਹਾਂਜੀ ਹਾਂਜੀ ਤੁਸੀਂ ਦੱਸੋ ਕਿਹੜੀ ਤੁਹਾਨੂੰ ਸ਼ਡਿਊਲ ਤੁਹਾਡਾ ਇਹ ਹੋਊਗਾ ਜੀ ਤਿਆਰੀ ਦੋ ਕੁ ਦੋ ਕੁ ਮਹੀਨਿਆਂ ਦੇ ਟਾਈਮ ਦੀ ਹੋਊਗੀ ਜੀ ਠੀਕ ਹੈ ਅਤੇ ਉਹਦੇ ਵਿੱਚ ਤੁਹਾਨੂੰ ਅਲੱਗ ਅਲੱਗ ਤਰ੍ਹਾਂ ਦੇ ਕਲਾਸਾਂ ਡਿਵਾਈਡ ਕਰਕੇ ਦੱਸ ਦਿੱਤੀਆਂ ਜਾਣਗੀਆਂ ਵੀ ਤੁਸੀਂ ਕਿਹੜੇ ਟਾਈਮ ਕਿਹੜੀ ਕਲਾਸ ਲਾਉਣੀ ਹੈ ਕਿਹੜੇ ਟਾਈਮ ਕਿਹੜੀ ਕਲਾਸ ਲਾਉਣੀ ਜਿਵੇਂ ਉਹਦੇ 'ਚ ਜਿਵੇਂ ਸਪੀਚਿੰਗ ਸਪੀਚ ਦਾ ਹੁੰਦਾ ਰੀਡਿੰਗ ਦਾ ਹੁੰਦਾ ਰਾਈਟਿੰਗ ਦਾ ਹੁੰਦਾ ਤੁਹਾਨੂੰ ਉਸ ਅਕੋਰਡਿੰਗ ਦੀ ਅੱਡ ਅੱਡ ਦੱਸ ਦਿੱਤੇ ਜਾਣਗੇ ਟਾਈਮ

ਟੋਟਲ ਤਿੰਨ ਕੁ ਘੰਟੇ ਹੋਇਆ ਕਰਨਗੇ ਜੀ ਆਪਣੀ ਫੀਸ ਹੈ ਜੀ ਪੱਚੀ ਹਜ਼ਾਰ ਹੈਗੀ ਹੈ ਜਿਹਦੇ ਵਿੱਚ ਤਿੰਨੇ ਕੋਰਸ ਤੁਹਾਡੇ ਕੰਪਲੀਟ ਹੋ ਜਾਣਗੇ ਨਹੀਂ ਕੋਈ ਗੱਲ ਨਹੀਂ ਬਾਕੀ ਤੁਸੀਂ ਆ ਜਿਓ ਆਪਾਂ ਦੇਖ ਲਵਾਂਗੇ ਤੁਹਾਡੇ ਡਾਕੂਮੈਂਟ ਦੇਖ ਲਵਾਂਗੇ ਅਤੇ ਫੇਰ ਜਿਵੇਂ ਇੰਟਰਵਿਊ ਹੋਊਗੀ ਉਸ ਅਕੋਰਡਿੰਗ ਵੀ ਆਪਾਂ ਦੇਖ ਲਵਾਂਗੇ ਜਿੰਨੀ ਜਲਦੀ ਤੁਸੀਂ ਆ ਜਾਉਂਗੇ ਕਿਉਂਕਿ ਸਾਡੇ ਕੋਲ ਰੂਟੀਨ ਵਾਈਜ ਅਸੀਂ ਬੈਚ ਸ਼ੁਰੂ ਕਰੀ ਜਾਂਦੇ ਰਹਿੰਦੇ ਹਾਂ ਜਿਵੇਂ ਤੁਸੀਂ ਆ ਜਾਉਂਗੇ ਤੁਹਾਡਾ ਬੈਚ ਸੈੱਟ ਕਰਵਾ ਦੇਵਾਂਗੇ ਅਸੀਂ ਹਾਂਜੀ ਸਾਰਾ ਕੁਛ ਤੁਹਾਨੂੰ ਤੁਹਾਨੂੰ ਗਰੁ ਗਰੁੱਪ 'ਚ ਪਾ ਦਿਆਂ ਕਰਾਂਗੇ ਜੇ ਤੁਸੀਂ ਲੈਣੀ ਹੈ ਕਾਪੀਆਂ ਲੈਣੀਆਂ ਕਾਪੀਆਂ ਤੁਹਾਨੂੰ ਹਰ ਤਰ੍ਹਾਂ ਨਾਲ ਮਟੀਰੀਅਲ ਦੇਵਾਂਗੇ ਤੁਸੀਂ ਸੁਭਾ ਦਸ ਵਜੇ ਆ ਸਕਦੇ ਹੋ ਜੀ ਕਦੋਂ ਕਿਸੇ ਦਿਨ ਵੀ ਸਾਡਾ ਜੀ ਪੰਜ ਵਜੇ ਤੱਕ ਹੁੰਦਾ ਹਾਂਜੀ ਹਾਂਜੀ ਠੀਕ ਹੈ ਜੀ